ਆਵਾਜਾਈ ਦੇ ਵਿਕਲਪ ਨਾਲ਼ ਸਾਡੇ ਮਨੁੱਖੀ ਜੀਵਨ ਉੱਤੇ ਬਹੁਤ ਗਹਿਰਾ ਪ੍ਰਭਾਵ ਪਿਆ ਅਵਾਜਾਈ ਦੇ ਸਾਧਨ ਵਧਣ ਨਾਲ ਸਾਡੇ ਦੇਸ਼ ਤਰੱਕੀ ਦੇ ਰਾਹ ਉੱਤੇ ਹੈ ਅਤੇ ਵਧੀਆ ਸੜਕਾਂ ਬਣਨ ਕਰਕੇ ਸਮੇਂ ਦੀ ਬੱਚਤ ਬਹੁਤ ਹੁੰਦੀ ਹੈ ਅਤੇ ਦੇਸ਼ ਵਿਕਾਸ ਦੇ ਰਾਹ ਉੱਤੇ ਦੌੜ ਰਿਹਾ ਹੈ ਕਿਉਂਕਿ ਆਵਾਜਾਈ ਦੇ ਸਾਧਨ ਕਰਕੇ ਹਰ ਵਰਗ ਦੇ ਉਦਯੋਗਿਕ ਖੇਤਰ ਵਿੱਚ ਤਰੱਕੀ ਹੋ ਰਹੀ ਹੈ ਜਿਸ ਨਾਲ਼ ਸਾਡੇ ਦੇਸ਼ ਵਿਕ ਵਿਕਸ ਵਿਕਸਿਤ ਹੋ ਰਿਹਾ ਹੈ ਅਤੇ ਮਨੁੱਖ ਦੀ ਜ਼ਿੰਦਗੀ ਸੁਖਾਲੀ ਹੋ ਗਈ ਹੈ ਆਵਾਜਾਈ ਦੇ ਸਾਧਨ ਵੱਧਣ ਕਰਕੇ ਯਾਤਰਾ ਦੇ ਵਿਕਲਪ ਵੱਧ ਗਏ ਹਨ ਅਤੇ ਅਲੱਗ ਅਲੱਗ ਜਗ੍ਹਾਵਾਂ ਉੱਤੇ ਜਾਣਾ ਆਸਾਨ ਹੋ ਗਿਆ ਹੈ ਜਿਸ ਨਾਲ਼ ਮਨੁੱਖ ਵਿਕਸਿਤ ਹੋਇਆ ਹੈ ਵਿਕਸਿਤ ਹੋਇਆ ਹੈ ਅਤੇ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ਅਤੇ ਮਹੱਤਵਪੂਰਨ ਵੱਧਦਾ ਹੈ ਨਵੇਂ ਨਵੇਂ ਅਨੁਭਵ ਮਿਲਦੇ ਹਨ ਪੁਰਾਣੇ ਸਮੇਂ ਵਿੱਚ ਆਵਾਜਾਈ ਦੇ ਇੰਨੇ ਸਾਧਨ ਨਹੀਂ ਸਨ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਬਹੁਤ ਸਮਾਂ ਲੱਗਦਾ ਸੀ ਅੱਜ ਦੇ ਸਮੇਂ ਵਿੱਚ ਆਵਾਜਾਈ ਦੇ ਸਾਧਨ ਬਹੁਤ ਵਿਕਸਿਤ ਹੋ ਗਏ ਨੇ ਜਿਸ ਕਰਕੇ ਸਮੇਂ ਦੀ ਬੱਚਤ ਬਹੁਤ ਹੁੰਦੀ ਹੈ ਇਹਨਾਂ ਸਾਧਨਾਂ ਵਿੱਚ ਮੋਟਰ ਗੱਡੀਆਂ ਅਤੇ ਜਹਾਜ਼ ਰੇਲ ਗੱਡੀਆਂ ਸ਼ਾਮਿਲ ਹਨ ਦੇ ਸਾਧਨਾਂ ਦੀ ਸਹਾਇਤਾ ਨਾਲ਼ ਸਮਾਨ ਮਨੁੱਖ ਅਸਾਨੀ ਨਾਲ਼ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਣ ਵਿੱਚ ਸਹਾਇਕ ਹੁੰਦੇ ਹਨ ਪੁਰਾਣੇ ਸਮੇਂ ਵਿੱਚ ਇਹਨਾਂ ਸਾਧਨਾਂ ਦੀ ਕਮੀ ਸੀ